ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਸੀਂ ਓਲੇ ਤੋਂ ਬੋਲਦੇ ਪਏ ਹੋ ਹਾਂਜੀ ਮੈਂ ਇੱਕ ਓਲੇ ਬੁੱਕ ਕੀਤੀ ਸੀ ਹਾਂਜੀ ਪ੍ਰੇਮ ਕੁਮਾਰ ਜੀ ਬੋਲਦੇ ਪਏ ਹੋ ਹਾਂਜੀ ਮੈਂ ਨਾ ਇੱਕ ਓਲੇ ਬੁੱਕ ਕੀਤੀ ਸੀ ਮੇਰੀ ਰਾਤ ਦੀ ਨਾ ਦੋ ਵਜੇ ਦੀ ਟ੍ਰੇਨ ਆ ਕੀ ਤੁਸੀਂ ਮੈਨੂੰ ਲਿਆਉਣ ਆ ਜਾਓਗੇ ਇੱਕ ਵਜੇ ਆ ਜਾਇਓ ਮੈਂ ਅੰਮ੍ਰਿਤਸਰ 'ਚ ਹੀ ਰਹਿੰਦੀ ਹਾਂ ਪੁਰਾਣੀ ਚੁੰਗੀ ਜਿਹੜੀ ਦਸਮੇਸ਼ ਸਾਹਿਬ ਨੇ ਉਹਦੇ ਨਾਲ ਆ ਜੀ ਐਨ ਡੀ ਯੂ ਦੇ ਕੋਲ ਹੀ ਆ ਤੁਸੀਂ ਇਕ ਵਜੇ ਆ ਜਾਓਗੇ ਮੈਨੂੰ ਟਾਈਮ ਵੀ ਦੱਸ ਦਿਓ ਕਿ ਮੈਂ ਕਿੰਨੇ ਕੁ ਵਜੇ ਪਹਿਲਾਂ ਉੱਥੇ ਪਹੁੰਚ ਜਾਵਾਂ ਅੱਛਾ ਦਸ ਮਿੰਟ ਪਹਿਲਾਂ ਹਾਂਜੀ ਹਾਂਜੀ ਪਹੁੰਚ ਜਾਊਂਗੀ ਬਸ ਤੁਸੀਂ ਆ ਜਾਇਓ ਅਤੇ ਮੈਨੂੰ ਦੋ ਵਜੇ ਤੋਂ ਪੰਦਰਾ ਕੁ ਮਿੰਟ ਪਹਿਲਾਂ ਹੀ ਪਹੁੰਚਾ ਦਿਓ ਉੱਥੇ ਕਿੰਨਾ ਕੁ ਟਾਈਮ ਲੱਗੇਗਾ ਅੱਧਾ ਘੰਟਾ ਹਾਂਜੀ ਹਾਂਜੀ ਕੋਈ ਨਾ ਹਾਂਜੀ ਹਾਂਜੀ ਤੁਸੀਂ ਆ ਜਾਇਓ ਮੈਨੂੰ ਉੱਥੇ ਤੱਕ ਪਹੁੰਚਾ ਦਿਓ ਪੈਸੇ ਮੈਨੂੰ ਦੱਸ ਦਿਓ ਪਹਿਲਾਂ ਹੀ ਜਿੰਨੇ ਵੀ ਹੋਣਗੇ ਮੈਂ ਦੇ ਦੂੰਦੂਗੀ ਬਸ ਜਲਦੀ ਆ ਜਾਇਓ ਅਤੇ ਮੈਨੂੰ ਉੱਥੇ ਤੱਕ ਪਹੁੰਚਾ ਦਿਓ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਦੋ ਵਜੇ ਦੀ ਟ੍ਰੇਨ ਆ ਮੇਰੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਹਾਂਜੀ ਬਹੁਤ ਬਹੁਤ ਧੰਨਵਾਦ